ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਮੈਂ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਹਾਂ ਜੋ ਕਿ ਪੰਜਾਬ ਵਿੱਚ ਸਥਿਤ ਹੈ ਹਾਂ ਮੈਨੂੰ ਕਿਸੇ ਚੀਜ਼ ਦਾ ਪੰਜਾਬੀ ਤੋਂ ਅਨੁਵਾਦ ਕਰਨ ਦੀ ਲੋੜ ਪਈ ਸੀ ਮੈਨੂੰ ਇੱਕ ਪੰਜਾਬੀ ਗੀਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਅਨੁਭਵ ਹੋਇਆ ਸੀ ਇਹ ਅਨੁਵਾਦ ਮੈਨੂੰ ਗੀਤ ਦੀ ਭਾਵ ਭਾਵਨਾਵਾਂ ਨੂੰ ਸਮਝਣ ਵਿੱਚ ਮਦਦ ਕਰ ਸਿੱਖਣ ਵਿੱਚ ਮੈਨੂੰ ਮਦਦ ਕੀਤੀ ਹਾਂ ਮੈਂ ਪਿਛਲੇ ਸਾਲ ਇੱਕ ਕੰਪਨੀ ਵਿੱਚ ਕੰਪਨੀ ਦੇ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਰਹੀ ਸੀ ਜੋ ਭਾਰਤੀ ਬਜ਼ਾਰ ਵਿੱਚ ਇੱਕ ਨਵੀਂ ਤਕਨੀਕ ਉਪਕਰਨ ਦੀ ਵਿਕਾਸ ਕਰ ਰਹੀ ਸੀ ਸਾਡੀ ਟੀਮ ਵਿੱਚ ਕੁਝ ਮੈਂਬਰ ਪੰਜਾਬੀ ਭਾਸ਼ਾ ਵਿੱਚ ਵਾਰਤਾ ਕਰਦੇ ਸਨ ਅਤੇ ਮੈਨੂੰ ਮੇਰੇ ਸਹਿਯੋਗੀ ਨੇ ਵੱਡੇ ਹੀ ਜੋਸ਼ ਨਾਲ ਕਿਹਾ ਚਲੋ ਸ਼ੁਰੂ ਕਰ ਦਿੱਤਾ ਕਹਿਣਾ ਸ਼ੁਰੂ ਕੀਤਾ ਕਿ ਇਹ ਇੱਥੇ ਬੋਲੋ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਸੀ ਉਹ ਪਰ ਜੋ ਉਸ ਦੀ ਸਮੱਸਿਆ ਸੀ ਉਹ ਪੰਜਾਬੀ ਭਾਸ਼ਾ ਵਿੱਚ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਅਨੁਭਵ ਬਹੁਤ ਹੀ ਅਲੱਗ ਰਿਹਾ ਮੈਨੂੰ ਆਪਣੇ ਅਨੁਵਾਦ ਤੋਂ ਸਿੱਖਣ ਨੂੰ ਮਿਲਿਆ ਕਿ ਸਾਨੂੰ ਭਾਸ਼ਾਵਾਂ ਟਰਾਂਸਲੇਟ ਕਰਨੀਆਂ ਆਉਣੀਆਂ ਚਾਹੀਦੀਆਂ ਹਨ ਜਦੋਂ ਵੀ ਅਸੀਂ ਕਿਤੇ ਯਾਤਰਾ ਕਰਦੇ ਹਾਂ ਤਾਂ ਸਾਨੂੰ ਯਾਤਰਾ ਵਿੱਚ ਹਰੇਕ ਤਰ੍ਹਾਂ ਦੇ ਵਿਅਕਤੀ ਨਾਲ ਅਨੁਭਵ ਕਰਨ ਨੂੰ ਮਿਲਦਾ ਹੈ ਸਾਨੂੰ ਹੋਰ ਹੋਰ ਭਾਸ਼ਾਵਾਂ ਦੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ ਜਿੱਦਾਂ ਕਿ ਅਸੀਂ ਸਫ਼ਰ ਕਰਦੇ ਹੋਈਏ ਤਾਂ ਸਾਨੂੰ ਓਥੇ ਹਿੰਦੀ ਉਰਦੂ ਬੰਗਾਲੀ ਬੋਲਣ ਵਾਲੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਦੀ ਗੱਲ ਗੱਲ ਸੁਣ ਕੇ ਸਾਨੂੰ ਪਹਿਲਾਂ ਆਪਣੀ ਭਾਸ਼ਾ ਪੰਜਾਬੀ ਵਿੱਚ ਅਨੁਵਾਦ ਕਰਨਾ ਪੈਂਦਾ ਹੈ ਜਾਂ ਫਿਰ ਅਗਰ ਅਸੀਂ ਕੋਈ ਹੋਰ ਭਾਸ਼ਾ ਬੋਲਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਅਨੁਵਾਦ ਕਰਨਾ ਪੈਂਦਾ ਹੈ ਅਤੇ ਉਸਨੂੰ ਗੱਲ ਸਮਝ ਕੇ ਫਿਰ ਉਹਦੇ ਜਵਾਬ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਅਨੁਵਾਦ ਕਰਕੇ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ ਤਾਂ ਕਿ ਉਨ੍ਹਾਂ ਨੂੰ ਸਮਝਣ ਵਿੱਚ ਅਸਾਨੀ ਹੋਏ ਅਤੇ ਉਨ੍ਹਾਂ ਨੂੰ ਸਾਡੇ ਨਾਲ ਵਾਰਤਾਲਾਪ ਕਰਨ ਵਿੱਚ ਕੰਫਰਟੇਬਲ ਫੀਲ ਹੋਏ ਭਾਸ਼ਾਵਾਂ ਦਾ ਅਨੁਵਾਦ ਕਰਨ ਦਾ ਅਨੁਭਵ ਬਹੁਤ ਹੀ ਦਿਲਚਸਪ ਹੁੰਦਾ ਹੈ ਸਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਸਾਨੂੰ ਦੂਜੇ ਭਾਸ਼ਾਵਾਂ ਦੇ ਸ਼ਬਦਾਂ ਦੀ ਜਾਣਕਾਰੀ ਮਿਲਦੀ ਹੈ ਸਾਨੂੰ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ ਜੋ ਕਿ ਸਾਡੀ ਨੌਲੇਜ ਲਈ ਬਹੁਤ ਹੀ ਚੰਗੀ ਗੱਲ ਹੈ ਸਾਡੀ ਨੌਲੇਜ ਵੱਧਦੀ ਹੈ ਔਰ ਇਨ੍ਹਾਂ ਅਨੁਵਾਦਾਂ ਦੇ ਨਾਲ ਹੀ ਅਸੀਂ ਇੱਕ ਦੂਸਰੇ ਦੀ ਭਾਵਨਾਵਾਂ ਨੂੰ ਸਮਝ ਸਕਦੇ ਹਾਂ ਅਗਰ ਅਸੀਂ ਕਿਸੇ ਦੀ ਭਾਸ਼ਾ ਸੁਣ ਕੇ ਇਨ੍ਹਾਂ ਉਸ ਨੂੰ ਐਦਾਂ ਹੀ ਜਵਾਬ ਦੇ ਦੇਈਏ ਤਾਂ ਸਾਨੂੰ ਉਸਨੂੰ ਉਸਦੇ ਜਜ਼ਬਾਤ ਨੂੰ ਕਦੇ ਵੀ ਸਮਝ ਨਹੀਂ ਸਕਦੇ ਅਸੀਂ ਉਨ੍ਹਾਂ ਦੇ ਐਕਪੀਰੀਐਂਸ ਨੂੰ ਕਦੇ ਵੀ ਫੀਲ ਨਹੀਂ ਕਰ ਸਕਦੇ ਕਿ ਉਹ ਉਸ ਸਿਚੂਏਸ਼ਨ ਵਿੱਚ ਕਿਵੇਂ ਫੀਲ ਕਰ ਰਿਹਾ ਹੈ ਇਸ ਕਰਕੇ ਸਾਨੂੰ ਉਨ੍ਹਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਆਪਣੀ ਭਾਸ਼ਾ ਵਿੱਚ ਆਪਣੀ ਸਮਝ ਵਿੱਚ ਲਿਆਉਣਾ ਜ਼ਰੂਰੀ ਹੈ ਉਨ੍ਹਾਂ ਦਾ ਅਨੁਵਾਦ ਕਰਨਾ ਜ਼ਰੂਰੀ ਹੈ ਅਨੁਵਾਦ ਕਰਨ ਨਾਲ ਹੀ ਅਸੀਂ ਗੱਲਾਂ ਸਮਝ ਸਕਦੇ ਹਾਂ ਸਾਨੂੰ ਦੂਸਰਿਆਂ ਦੀਆਂ ਗੱਲਾਂ ਸਮਝਣ ਲਈ ਉਨ੍ਹਾਂ ਨੂੰ ਵੀ ਇਹ ਕਹਿਣਾ ਚਾਹੀਦਾ ਹੈ ਕਿ ਤੁਸੀਂ ਅਨੁਵਾਦ ਕਰਕੇ ਆਪਣੀ ਭਾਸ਼ਾ ਵਿੱਚ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ